ਮੈਂ ਆਪਣੀ ਤਸਵੀਰਾਂ ਨੂੰ ਸੰਪਾਦਿਤ ਕਰਨ ਲਈ ਕਈ ਐਪਾਂ ਦਾ ਪ੍ਰਯੋਗ ਕਰਦੀ ਹਾਂ ਜਿਵੇਂ ਕਿ ਵੀ ਐਨ ਰਮੀਨੀ ਇਨਸ਼ੋਰਟ ਗੈਪਕਟ ਇਹ ਸਾਰੇ ਐਪ ਮੈਨੂੰ ਮੇਰੀ ਤਸਵੀਰ ਨੂੰ ਕਾਫ਼ੀ ਹੱਦ ਤੱਕ ਸਾਫ਼ ਕਰਨ ਲਈ ਮਦਦ ਕਰਦੇ ਨੇ ਇਨ ਐਪਾਂ ਦੇ ਕਾਰਨ ਹੀ ਮੇਰੀ ਤਸਵੀਰਾਂ ਦੇ ਬੈਕਗਰਾਊਂਡ ਵੀ ਕਾਫ਼ੀ ਹੱਦ ਤੱਕ ਸਾਫ਼ ਹੋ ਜਾਂਦੇ ਨੇ ਅਤੇ ਬੈਕਗਰਾਊਂਡ ਨੂੰ ਬਦਲਣ ਲਈ ਵੀ ਕਾਫ਼ੀ ਹੱਦ ਤੱਕ ਮਦਦ ਕਰਦੇ ਨੇ ਇਹਨਾਂ ਦੇ ਕਾਰਨ ਹੀ ਮੈਂ ਆਪਣੇ ਬੈਕਗਰਾਊਂਡ ਨੂੰ ਰੰਗ ਬਿਰੰਗਾ ਕਰ ਸਕਦੀ ਹਾਂ ਮੇਰੇ ਤਸਵੀਰਾਂ ਦੇ ਦਾਗ ਧੱਬੇ ਵੀ ਇਹਨਾਂ ਦੇ ਕਾਰਨ ਹੀ ਸਾਫ਼ ਹੋ ਹੁੰਦੇ ਨੇ ਅਤੇ ਮੈਂ ਇਹ ਐਪ ਕਾਫ਼ੀ ਚਿਰ ਤੋਂ ਵਰਤਦੀ ਹਾਂ ਅਤੇ ਹਜੇ ਵੀ ਵਰਤਣ ਲਈ ਇਹ ਹੀ ਮੈਨੂੰ ਕੰਮ ਆਉਂਦੇ ਨੇ ਅਤੇ ਮੈਂ ਆਪਣੀ ਤਸਵੀਰਾਂ ਨੂੰ ਵਧਾਉਣ ਲਈ ਕਈ ਤਕਨੀਕਾਂ ਅਤੇ ਸੋਸ਼ਲ ਮੀਡੀਆ ਐਪ ਨੂੰ ਵਰਤਦੀ ਹਾਂ ਜਿਵੇਂ ਕਿ ਇੰਸਟਾਗਰਾਮ ਵਟਸਅਪ ਸਨੈਪਚੈਟ ਮੈਂ ਆਪਣੀ ਤਸਵੀਰਾਂ ਨੂੰ ਇਹਨਾਂ ਦੇ ਥਰੂ ਹੀ ਆਪਣੀ ਤਸਵੀਰਾਂ ਨੂੰ ਵਧਾਉਂਦੀ ਹਾਂ